ਪੰਜਾਬ ਵਿੱਚ ਲੋਕਾਂ ਦੇ ਰੋਜ਼ਾਨਾ ਘਰੇਲੂ ਚੀਜ਼ਾਂ ਵਿੱਚ ਦੇਸੀ ਚੀਜ਼ਾਂ ਵਰਤੀਆਂ ਜਾਂਦੀਆਂ ਜਿਵੇਂ ਕਿ ਬ ਬੁਖਾਰ ਹੁੰਦਾ ਬੁਖਾਰ ਦੇ ਵਿੱਚ ਤੁਲਸੀ ਦੀ ਚਾਹ ਬਣਾ ਕੇ ਦੇਤੀ ਜਿਵੇਂ ਜੁਕਾਮ ਹੈ ਤਾਂ ਅਦਰਕ ਅਤੇ ਸ਼ਹਿਦ ਦੇਤਾ ਛੋਟੇ ਬੱਚੇ ਨੂੰ ਜਿਵੇਂ ਸੁਹਾਗਾ ਦੇ ਤਾ ਸ਼ਹਿਰ 'ਚ ਪਾ ਕੇ ਜਾਇਫਲ ਦੇ ਦਿੱਤਾ ਜਾਇਫਲ ਰਗੜ ਕੇ ਦੇ ਦਿੱਤਾ ਇੱਦਾਂ ਦੀਆਂ ਚੀਜ਼ਾਂ ਵਰਤੀਆਂ ਜਾਂਦੀਆਂ ਦੇਸੀ ਚੀਜ਼ਾਂ ਜਿਵੇਂ ਅਤੇ ਜਿਵੇਂ ਹੁਣ ਵਿਆਹ ਸ਼ਾਦੀ ਦੇ ਵਿੱਚ ਦੇਖਿਆ ਜਾਵੇ ਜਾਂ ਬੱਚੇ ਦੇ ਜਨਮ ਦੇ ਵਿੱਚ ਦੇਖੀਏ ਵੀ ਬੱਚਾ ਕੋਈ ਜਨਮ ਲੈਂਦਾ ਜੇ ਮੁੰਡਾ ਜਨਮ ਲੈਂਦਾ ਅਤੇ ਮੁੰਡੇ ਦੇ ਜਨਮ 'ਤੇ ਉਹਨਾਂ ਦੇ ਮਤਲਬ ਸਰੀਂ ਬੰਨੇ ਜਾਂਦੇ ਆ ਦਰਵਾਜਿਆਂ 'ਤੇ ਅਤੇ ਉਹਦੇ ਨਾਨਕੇ ਭੇਲੀ ਭੇਜੀ ਜਾਂਦੀ ਆ ਅਤੇ ਕੁੜੀ ਦੇ ਜਨਮ 'ਤੇ ਨਹੀਂ ਮਤਲਬ ਪਹਿਲਾਂ ਜ਼ਮਾਨੇ 'ਚ ਕੁਝ ਵੀ ਕਰਦੇ ਸੀ ਅੱਜ ਕੱਲ੍ਹ ਤਾਂ ਹੁਣ ਲੋਹੜੀ ਬਾਲਣ ਲੱਗ ਗਏ ਕੁੜੀ ਦੀ ਮੁੰਡੇ ਦੀ ਤਾਂ ਲੋਹੜੀ ਹੁੰਦੀ ਹੁੰਦੀ ਹੈ ਵੀ ਲੋਹੜੀ ਬਣਾਉਂਦੇ ਆ ਮੁੰਡਿਆਂ ਦੀ ਅਤੇ ਹੁਣ ਤਾਂ ਅੱਜ ਕੱਲ੍ਹ ਕੁੜੀਆਂ ਦੀ ਵੀ ਲੋਹੜੀ ਮਨਾਉਣ ਲੱਗ ਗਏ ਕੁੜੀਆਂ ਦੇ ਕਈ ਹੁਣ ਕੁੜੀਆਂ ਦੇ ਜਨਮ 'ਤੇ ਵੀ ਚੀਜ਼ਾਂ ਵੰਡ ਦਿੰਦੇ ਆ ਮਤਲਬ ਜਿਵੇਂ ਵੀ ਲੱਡੂ ਵੰਡਤੇ ਉਹਨਾਂ ਦੀ ਲੋਹੜੀ ਬਣਾਈ ਕਿੱਦਾਂ ਵਿਹਾਰ ਅੱਜ ਚਲ ਅੱਜ ਕੱਲ੍ਹ ਚੱਲ ਪਏ ਪਿਛਲੇ ਜ਼ਮਾਨੇ 'ਚ ਇੱਦਾਂ ਦੀ ਚੀਜ਼ਾਂ ਨਹੀਂ ਹੁੰਦੀਆਂ ਸੀ ਇਕੱਲੇ ਮੁੰਡੇ ਦੇ ਜਨਮ 'ਤੇ ਹੀ ਕਰਦੇ ਸੀ ਅਤੇ ਜਿਵੇਂ ਵਿਆਹ ਸ਼ਾਦੀ ਲੈ ਲਈਏ ਵਿਆਹ ਸ਼ਾਦੀ 'ਤੇ ਜਿਵੇਂ ਹੁਣ ਕੁੜੀ ਦਾ ਵਿਆਹ ਰੱਖ ਲਿਆ ਕੁੜੀ ਦੇ ਵਿਆਹ ਦੇ ਵਿੱਚ ਜਿਵੇਂ ਗਾਨੇ ਦੀ ਰਸਮ ਹੋ ਗਈ ਅਤੇ ਫਿਰ ਚੂੜੀਆਂ ਦੀ ਰਸਮ ਹੋ ਗਈ ਮਹਿੰਦੀ ਦੀ ਰਸਮ ਹੋ ਗਈ ਹਲਦੀ ਦੀ ਰਸਮ ਹੋ ਗਈ ਨਹਾਈ ਧੋਈ ਹੋਇਆ ਗੀਤ ਬਿਠਾਉਣੇ ਕੋਈ ਗਿਆਰ੍ਹਾਂ 'ਤੇ ਬਿਠਾਉਂਦਾ ਕੋਈ ਤੇਰ੍ਹਾਂ 'ਤੇ ਕੋਈ ਸੱਤਾਂ 'ਤੇ ਬਿਠਾਉਂਦਾ ਵੀ ਗੀਤ ਗੀਤ ਵੀ ਹੋ ਗਏ ਅਤੇ ਫਿਰ ਨਹਾਈ ਧੋਈ ਹੁੰਦੀ ਹੈ ਵਿਆਹ ਵਾਲੇ ਦਿਨ ਵਿਆਹ ਤੋਂ ਤਿੰਨ ਕੁ ਦਿਨ ਪਹਿਲਾਂ ਮਾਈਆਂ ਲੱਗਦਾ ਮਾਈਏ ਤੋਂ ਬਾਅਦ ਵਿੱਚ ਜਿਵੇਂ ਹੁੰਦਾ ਕੁੜੀ ਹੈ ਚਾਹੇ ਮੁੰਡਾ ਹੈ ਬਾਹਰ ਨਹੀਂ ਜਾ ਸਕਦੇ ਮਤਲਬ ਗਲੀ ਦਹਿਲੀਜ਼ ਨਹੀਂ ਘਰ ਦੀ ਪਾਰ ਕਰਦੇ ਫਿਰ ਜਿਵੇਂ ਮਾਈਆਂ ਮਾਈਆਂ ਤੋਂ ਬਾਅਦ ਵਿੱਚ ਫਿਰ ਨ ਉਹ ਹੋ ਗਏ ਨਹਾਈ ਧੋਈ ਹੁੰਦੀ ਹੈ ਸੁਬਹ ਨਹਾਈ ਧੋਈ ਤੋਂ ਬਾਅਦ ਨਹਾਈ ਧੋਈ ਹੋਣ ਜਿਵੇਂ ਹੁੰਦੀ ਹੈ ਅਤੇ ਮਾਮਾ ਮਤਲਬ ਚੱਪਣੀਆਂ ਰੱਖਦਾ ਚੱਪਣੀਆਂ ਤੋੜਦੇ ਆ ਭੰਨਦੇ ਆ ਗੋਦੀ ਚੱਕ ਕੇ ਬ ਕੁੜੀ ਆ ਚਾਹੇ ਮੁੰਡਾ ਆ ਉਹਨੂੰ ਮਤਲਬ ਫੁਲਕਾਰੀ ਦੇ ਕੇ ਅਤੇ ਉਹਨਾਂ ਨੂੰ ਉਹ ਚੱਪਣੀਆਂ ਚੱਕ ਕੇ ਚਪਣੀਆਂ 'ਤੇ ਮਤਲਬ ਛਾਲ ਮਾਰਦਾ ਚੱਪਣੀਆਂ ਭੰਨਦਾ ਹੁੰਦਾ ਫਿਰ ਉਸ ਤੋਂ ਬਾਅਦ ਵਿੱਚ ਮਾਮੇ ਲਈ ਨਾਨਕਿਆਂ ਵਾਲੀਆਂ ਮਤਲਬ ਕੁੜੀ ਦਾ ਚੂੜਾ ਪਾਇਆ ਜਾਂਦਾ ਕੁੜੀ ਚੂੜਾ ਪਾਉਂਦੀ ਹੈ ਮਤਲਬ ਨਾਲ ਨਾਲ ਮਾਮੀ ਮਾਮਾ ਮਾਮੀ ਰਸਮ ਇਹ ਅਦਾ ਕਰਦੇ ਹੈ ਫਿਰ ਆਨੰਦ ਕਾਰਜ ਦੀ ਰਸਮ ਅਦਾ ਹੁੰਦੀ ਹੈ ਐਵੇਂ ਹੀ ਮੁੰਡੇ ਦੇ ਵਿਆਹ ਦੇ ਵਿੱਚ ਹੈ ਮੁੰਡੇ ਦੇ ਵਿਆਹ ਦੇ ਵਿੱਚ ਵੀ ਜਿਵੇਂ ਮਹਿੰਦੀ ਵੀ ਲਾ ਹੀ ਲੈਂਦੇ ਹੈ ਅਤੇ ਮਾਈਆਂ ਵੀ ਬਿਠਾਉਂਦੇ ਹੈ ਅਤੇ ਫਿਰ ਕੀ ਨਾਮ ਹੈਗੇ ਆ ਨਹਾਈ ਧੋਈ ਹੁੰਦੀ ਹੈ ਮਾਮਾ ਉਵੇਂ ਚੱਪਣੀਆਂ ਭੰਨਦਾ ਜਿਵੇਂ ਗੋਦੀ ਚੱਕ ਕੇ ਸਗਨ ਦਿੰਦਾ ਅਤੇ ਫਿਰ ਕੀ ਨਾਮ ਹੈਗੇ ਆ ਬਰਾਤ ਚੜਦੀ ਆ ਬਰਾਤ ਲੈ ਕੇ ਜਾਂਦੇ ਆ ਇੱਦਾਂ ਵਿਆਹ ਦੀ ਰਸਮ ਅਦਾ ਹੁੰਦੀ ਹੈਗੀ ਹੈ ਅਤੇ ਫਿਰ ਜਿਵੇਂ ਜੇ ਕੋਈ ਡੈਥ ਦਾ ਹੁੰਦਾ ਜਿਵੇਂ ਬੁੜੀ ਦਾ ਬੁੜੀ ਦੀ ਡੈਥ ਹੁੰਦੀ ਹੈ ਤਾਂ ਬੁੜੀ ਦੇ ਡੈਥ 'ਤੇ ਤਾਂ ਉਹਦੇ ਸਹੁਰਿਆਂ ਪੇਕਿਆਂ ਤੋਂ ਹੀ ਸੂਟ ਪੈਂਦਾ ਅਤੇ ਜਿਵੇਂ ਜੇ ਕਿਸੇ ਬੰਦੇ ਦੀ ਹੁੰਦੀ ਹੈ ਡੈਥ ਤਾਂ ਵੀ ਉਹਦੇ ਸੋਹਰਿਆਂ ਤੋਂ ਹੀ ਸੂਟ ਆਉਂਦਾ ਇੱਦਾਂ ਦੀ ਮਤਲਬ ਚਲਦਾ ਹੈਗਾ